ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਜੇਕਰ ਅੱਜ ਆਪਾਂ ਗੱਲ ਕਰੀਏ ਆਵਾਜਾਈ ਦੀ ਅੱਜ ਕੱਲ੍ਹ ਆਵਾਜਾਦ ਦਾ ਬਹੁਤ ਹੀ ਵੱਧ ਚੁੱਕੀ ਹੈ ਕਿਉਂਕਿ ਹਰ ਇੱਕ ਘਰ ਅਤੇ ਹਰ ਇੱਕ ਵਿਅਕਤੀ ਕੋਲ ਚ ਮੋਟਰਸਾਈਕਲ ਕਾਰਾਂ ਬ ਵੱਧ ਗਈਆਂ ਹਨ ਕਿਉਂਕਿ ਹਰ ਇੱਕ ਇਹਦਾ ਫਾਇ ਲੋਕ ਫਾਇਦਾ ਲੈਣਾ ਚਾਹੁੰਦੇ ਹਨ ਪਰ ਜੇਕਰ ਅਗਰ ਸਾਨੂੰ ਇਸ ਦਾ ਬਹੁਤ ਹੀ ਵੱਡਾ ਨੁਕਸਾਨ ਹੁੰਦਾ ਜੇਕਰ ਅਸੀਂ ਆਪਣੇ ਨੇੜਲੇ ਸ਼ਹਿਰ ਖੈੜ ਦੀ ਗੱਲ ਕਰੀਏ ਉੱਥੇ ਟ੍ਰੈਫਿਕ ਦੀ ਬਹੁਤ ਹੀ ਜ਼ਿਆਦਾ ਸਮੱਸਿਆ ਰਹਿੰਦੀ ਹਨ ਉੱਥੇ ਲੋਕਾਂ ਨੂੰ ਹ ਹਰ ਇੱਕ ਟਾਇਮ ਖੈੜ ਨੂੰ ਪਾਰ ਕਰਨ ਦੇ ਲਈ ਘੰਟਾ ਘੰਟਾ ਲੱਗ ਜਾਂਦਾ ਹੈ ਭਾਵੇਂ ਉੱਥੇ ਸੜਕਾਂ ਵੀ ਬਣ ਚੁੱਕੀਆਂ ਚੁੱਕੀਆਂ ਹਨ ਪਰ ਜਿਹੜੀ ਟ੍ਰੈਫਿਕ ਦੀ ਹੈ ਟ੍ਰੈਫਿਕ ਹੈ ਉਹ ਨਹੀਂ ਘੱਟ ਰਹੀ